ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਮਿਊਜ਼ਿਕ ਟੀਚਰ ਬੋਲ ਰਹੀ ਹਾਂ ਦੱਸੋ ਤੁਸੀਂ ਮੈਂ ਤੁਹਾਡੀ ਕੀ ਹੈਲਪ ਕਰ ਸਕਦੀ ਹਾਂ ਹਾਂਜੀ ਤੁਸੀਂ ਇੱਥੋਂ ਦੇ ਮਿਊਜ਼ਿਕ ਬਾਰੇ ਬਹੁਤ ਕੁਛ ਸੁਣ ਸਕਦੇ ਹੋ ਜਿਵੇਂ ਬਹੁਤ ਸਾਰੀਆਂ ਪਰਸਨੈਲਿਟੀਜ ਨੇ ਜਿਵੇਂ ਸਤਿੰਦਰ ਸਰਤਾਜ ਨੇ ਕਨਵਰ ਗਰੇਵਾਲ ਨੇ ਅਤੇ ਉਹਨਾਂ ਦੇ ਮਿਊਜ਼ਿਕ ਬਹੁਤ ਹੀ ਵਧੀਆ ਹੁੰਦੇ ਨੇ ਤੁਸੀਂ ਸੁਣ ਸਕਦੇ ਹੋ ਅਤੇ ਆਹ ਹਾਲੀ 'ਚ ਹਾਲੇ ਕੱਲ੍ਹ ਪਰਸੋਂ ਸਤਿੰਦਰ ਸਰਤਾਜ ਨੇ ਆਉਣਾ ਤਾਂ ਤੁਸੀਂ ਉੱਥੇ ਆ ਕੇ ਉਹਨਾਂ ਦਾ ਮਿਊਜ਼ਿਕ ਸੁਣ ਸਕਦੇ ਹੋ ਅਤੇ ਤੁਸੀਂ ਉਹਨਾਂ ਨੂੰ ਮਿਲ ਵੀ ਸਕਦੇ ਹੋ ਹਾਂਜੀ ਜੀ ਧੰਨਵਾਦ ਜੀ